ਯੋਗਾ ਸ਼ੁਰੂ ਕਰਨਾ ਹਰ ਉਮਰ ਦੇ ਵਿਅਕਤੀ ਲਈ ਇੱਕ ਬਹੁਤ ਹੀ ਵਧੀਆ ਅਤੇ ਲਾਭਕਾਰੀ ਫੈ ਫੈਸਲਾ ਹੋ ਸਕਦਾ ਹੈ ਯੋਗਾ ਕੇਵਲ ਇੱਕ ਕਸਰਤ ਨਹੀਂ ਸਗੋਂ ਇਹ ਮਨ ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਦਾ ਹੈ ਕਰਨ ਦਾ ਇੱਕ ਪ੍ਰਤੀਕਾਰ ਢੰਗ ਹੈ ਜਦੋਂ ਅਸੀਂ ਯੋਗਾ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਡਾ ਸਰੀਰ ਧੀਰੇ ਧੀਰੇ ਲਚਕਦਾਰ ਬਣਦਾ ਹੈ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਯੋਗਾ ਵਿੱਚ ਵੱਖ ਵੱਖ ਆਸਨ ਪ੍ਰਾਣਾ ਪ੍ਰਾਣਾਯਾਮ ਅਤੇ ਧਿਆਨ ਸ਼ਾਮਿਲ ਹੁੰਦੇ ਹਨ ਜੋ ਕਿ ਸਾਡੀ ਦਿਮਾਗੀ ਸ਼ਾਂਤੀ ਕੇਂਦਰਤਾ ਅਤੇ ਸਹਿਣਸ਼ੀਲਤਾ ਨੂੰ ਵਧਾਉਂਦੇ ਹਨ ਜੇਕਰ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਯੋਗਾ ਨਾਲ ਕਰੀਏ ਤਾਂ ਅਸੀਂ ਪੂਰੇ ਦਿਨ ਤਾਜ਼ਗੀ ਮਹਿਸੂਸ ਕਰਦੇ ਹਾਂ ਅਤੇ ਸਾਡੀ ਉਤ ਉਤਸ਼ਾਹ ਸ਼ੀਲਤਾ ਵੀ ਵੱਧਦੀ ਹੈ ਅਕਸਰ ਲੋਕ ਯੋਗਾ ਕਰਨਾ ਇਸ ਲਈ ਵੀ ਸ਼ੁਰੂ ਕਰਦੇ ਹਨ ਕਿਉਂਕਿ ਇਹ ਤਣਾਅ ਘਟਾਉਣ ਡਿਪਰੈਸ਼ਨ ਦੂਰ ਕਰਨ ਅਤੇ ਆਤਮ ਵਿਸ਼ਵਾਸ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਅਧਿਐਨ ਵੀ ਸਾਬਤ ਕਰਦੇ ਹਨ ਕਿ ਨਿਯਮਿਤ ਯੋਗ ਅਭਿਆਸ ਹਾਰਟ ਬਲੱਡ ਪ੍ਰੈਸ਼ਰ ਡਾਇਬਿਟੀਜ ਅਤੇ ਹੋਰ ਬਿਮਾਰੀਆਂ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ